ਪਿਛਲੇ ਕੁਝ ਦਹਾਕਿਆਂ ਤੋਂ ਜਿਹੜੀ ਨੌਕਰੀਆਂ ਦਾ ਜਿਹੜਾ ਨੌਕਰੀਆਂ ਦਾ ਢਾਂਚਾ ਹੈ ਉਹ ਬਦਲਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਦੇ ਜਿਹੜੇ ਨੌਜਵਾਨ ਹਨ ਉਹ ਜ਼ਿਆਦਾਤਰ ਤੈਕਨਾਲਜੀ ਸੰਬੰਧਿਤ ਜਗਤ ਵੱਲ ਭੱਜ ਰਹੇ ਹਨ ਜ਼ਿਆਦਾ ਕੰਪਨੀਆਂ ਦੇ ਅੰਦਰ ਕੰਮ ਕਰਨਾ ਸੋਫਟਵੇਅਰ ਇੰਜੀਨੀਅਰ ਜਾਂ ਆਦਿ ਵਜੋਂ ਜਾਂ ਫਿਰ ਸਿੱਧਾ ਹੀ ਜਿਹੜਾ ਨਿਰਮਾਤਾ ਬਣਨਾ ਸਮੱਗਰੀ ਦੇ ਜਾਂ ਕਹਿ ਲਉ ਯੂਟਿਊਬਰ ਬਣ ਜਾਣਾ ਗੇਮਰ ਬਣ ਜਾਣਾ ਉਦਾਹਰਨ ਤੌਰ 'ਤੇ ਜਾਂ ਫਿਰ ਸਟੈਂਡ ਅਪ ਕਮੇਡੀਅਨ ਹੋ ਗਏ ਫੂਡ ਬਲੋਗਰ ਹੋ ਗਏ ਇਹ ਸਭ ਜਿਹੜਾ ਵੀ ਕੰਜੂਬਰ ਕੰਜਊਮਰ ਬੇਸਡ ਉਪਭੋਗਤਾ ਦੇ ਆਧਾਰਿਤ ਜਿਹੜਾ ਕਾਰਜ ਹੈ ਇਹ ਇਹਨੂੰ ਆਪਣੇ ਜਿਹੜੀ ਨੌਕਰੀਆਂ ਦਾ ਹੈ ਜਾਂ ਜਿਹੜਾ ਕਿ ਕਿਰਤ ਦਾ ਜਿਹੜਾ ਆਧਾਰ ਬਣਾਇਆ ਜਾ ਰਿਹਾ ਪਰ ਜੇ ਦੇਖਿਆ ਜਾਵੇ ਇਹ ਤੋਂ ਇਲਾਵਾ ਹੋਰ ਬਾਕੀ ਪ੍ਰੋਫੈਸਰਾਂ ਵੱਲ ਜਾਂ ਫਿਰ ਜਿਹੜਾ ਅਕੈਡਮੀਆਂ ਦੀ ਜਿਹੜਾ ਜਿਹੜਾ ਜਗਤ ਹੈ ਵਿਦਵਤਾ ਦਾ ਜਗਤ ਹੈ ਉਹਦੇ ਵੱਲ ਵੀ ਨੌਜਵਾਨ ਕਾਫੀ ਝੁਕਾਅ ਰੱਖਦੇ ਹਨ ਇਹ ਤੋਂ ਇਲਾਵਾ ਬਾਹਰ ਜਾਣ ਦੇ ਅੰਦਰ ਭਾਰਤ ਛੱਡ ਕੇ ਹੋਰ ਵਿਦੇਸ਼ਾਂ ਦੇ ਅੰਦਰ ਜਾਂ ਕੰਪਨੀਆਂ 'ਚ ਕੰਮ ਕਰਨਾ ਜਾਂ ਫਿਰ ਪੜ੍ਹਾਈ ਕਰਨੀ ਇਹਦੇ ਵੱਲ ਵੀ ਕਾਫੀ ਝੁਕਾਅ ਨਜ਼ਰ ਆਉਂਦਾ ਹੈ